ਅਸੀਂ ਪਰਿਵਾਰ ਵਿੱਚ ਪੰਜ ਮੈਂਬਰ ਹਨ ਮੇਰੇ ਘਰ ਵਿੱਚ ਮੇਰੀਆਂ ਦੋ ਵੱਡੀਆਂ ਭੈਣਾਂ ਅਤੇ ਮੇਰੇ ਮਾਂ ਬਾਪ ਹਨ ਮੇਰੀ ਵੱਡੀ ਭੈਣ ਜੋ ਕਿ ਹਾਲੇ ਹੁਣ ਹੀ ਵਿਆਹੀ ਗਈ ਹੈ ਅਤੇ ਮੇਰੀ ਛੋਟੀ ਭੈਣ ਜੋ ਕਿ ਪੇਸ਼ੇ ਵਜੋਂ ਇੱਕ ਅਧਿਆਪਕ ਹੈ ਅਤੇ ਮੇਰੇ ਲਾਗੇ ਪਾਸੇ ਦੇ ਆਂਢੀ ਗੁਆਂਢੀ ਵਿੱਚ ਬਥੇਰੇ ਦੋਸਤ ਹਨ ਇੱਕ ਦੋਸਤ ਆ ਮੇਰਾ ਭਾਈਆਂ ਵਰਗਾ ਹੈ ਜੋ ਕਿ ਹਾਲੇ ਹੁਣ ਹੀ ਥੋੜ੍ਹੇ ਦਿਨ ਪਹਿਲਾਂ ਹੀ ਵਿਦੇਸ਼ ਗਿਆ ਹੈ ਅਤੇ ਮੇਰੇ ਨਾਲ ਪੜ੍ਹਦੇ ਮੇਰੇ ਕਈ ਯਾਰ ਦੋਸਤ ਵੀ ਹਨ ਜੋ ਕਿ ਆਪਣੇ ਸੁਭਾਅ ਵਜੋਂ ਮੇਰੇ ਘਰ ਵਿੱਚ ਮੇਰੇ ਭਰਾਵਾਂ ਵਾਂਗ ਹੀ ਵਿਚਰਦੇ ਹਨ ਅਤੇ ਮੇਰੇ ਘਰ ਦੇ ਮੇਰੇ ਨਾਲੋਂ ਜ਼ਿਆਦਾ ਉਹਨਾਂ 'ਤੇ ਭਰੋਸਾ ਕਰਦੇ ਹਨ